ਹੈਲੋ ਹੈਲੋ ਮੇ ਕਿਆ ਮੇਰੀ ਗੱਲ ਗਰਗ ਇਲੈਕਟ੍ਰੀਸ਼ਨ ਅ ਇਲੈਕਟ੍ਰੋਨਿਕਸ ਨਾਲ ਹੋ ਰਹੀ ਹੈ ਜੀ ਹਾਂਜੀ ਮੈਨੇ ਮੇਰੇ ਨਾ ਜੀ ਟੀ ਵੀ ਖਰੀਦਣਾ ਸੀ ਅਤੇ ਮੈਨੂੰ ਨਾ ਤੁਹਾਡਾ ਨੰਬਰ ਮੇਰੇ ਫਰੈਂਡ ਨੇ ਸੁਜੈਸਟ ਕੀਤਾ ਸੀ ਕਿ ਤੁਹਾਡੀ ਸ਼ੋਪ ਤੋਂ ਬਹੁਤ ਅੱਛੇ ਟੀ ਵੀ ਵਗੈਰਾ ਨੇ ਅਤੇ ਹੋਰ ਵੀ ਸਪੀਕਰ ਵਗੈਰਾ ਨੇ ਕਿਆ ਤੁਸੀਂ ਮੈਨੂੰ ਉਹਨਾਂ ਬਾਰੇ ਦੱਸ ਸਕਦੇ ਹੋ ਹਾਂਜੀ ਵੈਸੇ ਤਾਂ ਮੈਨੇ ਕਾਫੀ ਟੀ ਵੀ ਮਤਲਬ ਔਨਲਾਈਨ ਚੈੱਕ ਕੀਤੇ ਸੀ ਉਹਨਾਂ ਦੇ ਮੈਨੂੰ ਬਜਟ ਬਹੁਤ ਜ਼ਿਆਦੇ ਲੱਗਿਆ ਤਾਂ ਤੁਸੀਂ ਮੈਨੂੰ ਘੱਟ ਬਜਟ ਵਾਲਾ ਜਿਹੜਾ ਆ ਵਧੀਆ ਟੀ ਵੀ ਦਿਖਾ ਸਕਦੇ ਹੋ ਮਤਲਬ ਕਿ ਐੱਲ ਈ ਡੀ ਵਗੈਰਾ ਹਾਂਜੀ ਤੁਸੀਂ ਦੱਸ ਸਕਦੇ ਹੋ ਮਤਲਬ ਜਿਹੜੀ ਐੱਲ ਈ ਡੀ ਆ ਉਹਦੀ ਮਤਲਬ ਕਿਹੜੀ ਤੁਹਾਡੇ ਕੋਲ ਕੰਪਨੀਆਂ ਦੀਆਂ ਨੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਹਨਾਂ ਜ਼ਿਆਦਾ ਵਧੀਆ ਕਿਹੜੀ ਕੰਪਨੀ ਹੈ ਅਤੇ ਮਤਲਬ ਕਿੰਨੀ ਜ਼ਿਆਦਾ ਉਹਦੀ ਵਾਰੰਟੀ ਰਹਿੰਦੀ ਐੱਲ ਈ ਡੀ ਦੀ ਅਤੇ ਉਹਦੀ ਕੁਆਲਿਟੀ ਕਿੰਨੀ ਜ਼ਿਆਦਾ ਅੱਛੀ ਹੈ ਐੱਲ ਈ ਡੀ ਦੀ ਹਾਂਜੀ ਕਿਆ ਤੁਸੀਂ ਮੈਨੂੰ ਇਹਨਾਂ ਦੇ ਪ੍ਰਾਈਜ਼ ਵਗੈਰਾ ਦੱਸ ਸਕਦੇ ਹੋ ਜੀ ਮਤਲਬ ਕਿੰਨੀ ਇੰਚ ਦੀ ਐੱਲ ਈ ਡੀ ਦੇ ਕਿੰਨੇ ਪ੍ਰਾਈਜ਼ ਹੋਣਗੇ ਚਲੋ ਠੀਕ ਹੈ ਜੀ ਤੁਸੀਂ ਮੈਨੂੰ ਆਪਣਾ ਵਟਸਐਪ 'ਤੇ ਮਤਲਬ ਜਿੰਨੇ ਤੁਹਾਡੀ ਸ਼ੋਪ ਦੀ ਓਪ ਸ਼ੋਪ ਦੀ ਓਪਨਿੰਗ ਟਾਈਮ ਹੈ ਤੁਸੀਂ ਮੈਨੂੰ ਸੈਂਡ ਕਰ ਦਿਓ ਮੈਂ ਤਾਂ ਕਿ ਮੈਂ ਆ ਕੇ ਤੁਹਾਡੀ ਸ਼ੋਪ 'ਤੇ ਆਪਣੀ ਮਤਲਬ ਐੱਲ ਈ ਡੀ ਵਗੈਰਾ ਦੇਖ ਸਕਾਂ ਓਕੇ ਥੈਂਕ ਯੂ